ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਅਤੇ ਮੇਰਾ ਪਿੰਡ ਬਟਾਲਾ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦਾ ਹੈ ਅਤੇ ਸਰ ਸਾਡੇ ਘਰ ਨਾ ਥੋੜ੍ਹੇ ਜਿਹਾ ਨਵੀਨੀਕਰਨ ਲਈ ਕੰਮ ਚੱਲ ਰਿਹਾ ਸੀ ਅਤੇ ਨਵੀਨੀਕਰਨ ਕਰਦੇ ਸਮੇਂ ਮਿਸਤਰੀ ਕੋਲੋਂ ਬੀ ਐਸ ਐਨ ਐਲ ਦੇ ਫੋਨ ਦੀਆਂ ਤਾਰਾਂ ਅਤੇ ਬਰੋਡਬੈਂਡ ਦੇ ਥੋੜ੍ਹੀਆਂ ਜਿਹੀਆਂ ਤਾਰਾਂ ਕੱਟੀਆਂ ਗਈਆਂ ਹਨ ਜਿਸ ਕਰਕੇ ਸਰ ਸਾਡਾ ਸੰਪਰਕ ਬਾਹਰੀ ਦੁਨੀਆ ਨਾਲੋਂ ਟੁੱਟ ਗਿਆ ਹੈ ਅਤੇ ਇਸ ਇਸ ਨੁਕਸਾਨੀ ਗਈ ਤਾਰਾਂ ਲਈ ਅਸੀਂ ਮੁ ਮੁਰੰਮਤ ਕਰਵਾਉਣੀ ਚਾਹੁੰਦੇ ਹਾਂ ਅਤੇ ਅਸੀਂ ਇਸ ਫੋਨ ਕਾਲ ਰਾਹੀਂ ਤੁਹਾਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਕਿ ਸਾਡੀ ਜਲਦ ਤੋਂ ਜਲਦ ਜੋ ਸੰਪਰਕ ਹੈ ਦੁਨੀਆ ਨਾਲ ਦੁਬਾਰਾ ਬਹਾਲ ਕੀਤਾ ਜਾ ਸਕੇ ਅਤੇ ਅਸੀਂ ਤੁਹਾਡੇ ਬੇਨਤੀ ਕਰਦੇ ਹਾਂ ਤੁਸੀਂ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਸਾਨੂੰ ਸਾਡੀਆਂ ਜੋ ਨੁਕਸਾਨੀਆਂ ਗਈਆਂ ਤਾਰਾਂ ਉਸਨੂੰ ਦੁਬਾਰਾ ਬਹਾਲ ਕਰਕੇ ਨੈੱਟਵਰਕ ਨਾਲ ਜੋੜ ਦਿਉਂਗੇ ਅਤੇ ਅਸੀਂ ਆਸ ਕਰਦੇ ਹਾਂ ਤੁਸੀਂ ਜਲਦੀ ਹੀ ਸਾਡੇ ਘਰ ਆ ਕੇ ਇਸ ਨੂੰ ਠੀਕ ਕਰ ਦਿਉਂਗੇ